ਪੰਜਾਬੀ ਸਾਹਿਤ ਵਿੱਚ ਬਹੁਤ ਸਾਰੀਆਂ ਵਿਧਾਵਾਂ ਹਨ ਜਿਹਨਾਂ ਦੇ ਵਿੱਚ ਕਵਿਤਾਵਾਂ ਨਾਵਲ ਕਹਾਣੀ ਕਥਾਵਾਂ ਆਉਂਦੀਆਂ ਹਨ ਅਤੇ ਵਿਧਾਵਾਂ ਦੇ ਅੱਲਗ ਅਲੱਗ ਰੂਪ ਹਨ ਉਨ੍ਹਾਂ ਰੂਪਾਂ ਦੇ ਅਨੁਸਾਰ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਹੈ